ਵੈਸੇ ਤਾਂ ਮੇਰੇ ਮਨ ਪਸੰਦ ਕਵੀ ਅਤੇ ਲੇਖਕ ਬਹੁਤ ਸਾਰੇ ਹਨ ਅਤੇ ਮੈਂ ਲਿਖਦਾ ਅਤੇ ਪੜ੍ਹਦਾ ਵੀ ਸਭ ਨੂੰ ਰਹਿੰਦਾ ਹਾਂ ਪਰ ਮੇਰਾ ਸਭ ਤੋਂ ਮਨ ਪਸੰਦ ਲੇਖਕ ਅਤੇ ਕਵੀ ਸ਼ਿਵ ਕੁਮਾਰ ਬਟਾਲਵੀ ਹਨ ਅਤੇ ਮੈਂ ਜ਼ਿਆਦਾ ਉਹਨਾਂ ਨੂੰ ਹੀ ਸੁਣਦਾ ਹਾਂ ਮੈਂ ਜਦੋਂ ਵੀ ਵਿਹਲਾ ਹੁੰਦਾ ਹਾਂ ਮੈਂ ਉਹਨਾਂ ਦੀਆਂ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ ਮੈਂ ਉਂਝ ਵੀ ਜਦੋਂ ਕਿਤੇ ਵੀ ਲਾਇਬ੍ਰੇਰੀ ਵਿੱਚ ਜਾਂਦਾ ਹਾਂ ਤਾਂ ਮੈਂ ਮੈਂ ਉੱਥੇ ਵੀ ਸ਼ਿਵ ਕੁਮਾਰ ਬਟਵਾ ਬਟਾਲਵੀ ਜੀ ਨੂੰ ਹੀ ਪੜ੍ਹਨਾ ਪਸੰਦ ਕਰਦਾ ਹਾਂ ਅਤੇ ਮੈਂ ਅਕਸਰ ਵੀ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਪੁਸਤਕਾਂ ਹੀ ਖਰੀਦਦਾ ਹਾਂ ਮੇਰੇ ਘਰ ਵਿੱਚ ਉਹਨਾਂ ਦੀਆਂ ਪੁਸਤਕਾਂ ਜ਼ਿਆਦਾ ਹਨ ਮੈਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਪਸੰਦ ਵੀ ਤਾਂ ਕਰਦਾ ਹਾਂ ਕਿਉਂਕਿ ਜਦੋਂ ਮੈਂ ਦੁਖੀ ਹੁੰਦਾ ਹਾਂ ਤਾਂ ਮੈਨੂੰ ਉਹਨਾਂ ਦੀਆਂ ਪੁਸਤਕਾਂ ਪੜ੍ਹ ਕੇ ਬਹੁਤ ਸਕੂਨ ਮਿਲਦਾ ਹੈ ਅਤੇ ਪੜ੍ਹਦੇ ਸਮੇਂ ਮੈਨੂੰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਕਦੋਂ ਟਾਈਮ ਨਿਕਲ ਜਾਂਦਾ ਹੈ